ਜਿਵੇਂ ਕਿ ਮਾਨਸਿਕ ਤੌਰ 'ਤੇ ਕਈ ਬਿਮਾਰੀਆਂ ਹੁੰਦੀਆਂ ਹਨ ਜਿਵੇਂ ਕਿ ਸਿਰ ਦਰਦ ਦਿਲ ਦੀ ਬਿਮਾਰੀ ਕਈ ਤਰ੍ਹਾਂ ਦੇ ਰੋਗ ਹੁੰਦੇ ਹਨ ਜੋ ਕਿ ਸਾਡੇ ਕਈ ਸਰਕਾਰੀ ਹਸਪਤਾਲਾਂ ਵਿੱਚ ਵੀ ਇਹਨਾਂ ਦਾ ਇਲਾਜ ਹੈ ਅਤੇ ਕਈ ਲੋਕਾਂ ਨੂੰ ਤਾਂ ਕਈ ਕੇਂਦਰਾਂ ਬਾਰੇ ਪਤਾ ਹੀ ਨਹੀਂ ਅਤੇ ਕਈਆਂ ਵਿੱਚ ਸਾਨੂੰ ਬਹੁਤ ਜ਼ਿਆਦਾ ਸਹਾਇਤਾ ਮਿਲਦੀ ਪਰ ਕੁਝ ਲੋਕਾਂ ਨੂੰ ਤਾਂ ਆਪਣੀ ਬਿਮਾਰੀ ਦਾ ਹੀ ਨਹੀਂ ਪਤਾ ਲੱਗਦਾ ਇਸ ਲਈ ਉਹ ਸਮਾਜ ਤੋਂ ਲੁਕਾਉਂਦੇ ਰਹਿੰਦੇ ਹਨ ਇਸ ਲਈ ਸਾਨੂੰ ਆਪਣੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਸਰਕਾਰੀ ਹੋਸਪਿਟਲਾਂ ਵਿੱਚ ਜਾਣਾ ਚਾਹੀਦਾ ਹੈ ਇਸ ਲਈ ਸਰਕਾਰੀ ਕੇਂਦਰ ਸਾਡੀ ਬਹੁਤ ਮਦਦ ਕਰਦੇ ਹਨ